ਹੈਲੋ ਹਾਂਜੀ ਬਠਿੰਡਾ ਟੂਰਿਸਟ ਟੂਰਿਸਟ ਗਾਈਡ ਗੱਲ ਕਰਦੇ ਹੋ ਜੀ ਹਾਂਜੀ ਅਸੀਂ ਨਾ ਬਠਿੰਡਾ ਟੂਰ 'ਤੇ ਆ ਰਹੇ ਸੀਗੇ ਅਤੇ ਅਸ ਬਠਿੰਡੇ ਦੀਆਂ ਜਿਹੜੀਆਂ ਇਤਿਹਾਸਿਕ ਥਾਵਾਂ ਨੇ ਜਿਵੇਂ ਕਿਲ੍ਹਾ ਮੁਬਾਰਕ ਉਹ ਥਾਵਾਂ 'ਤੇ ਅਸੀਂ ਘੁੰਮ ਅਸੀਂ ਬਠਿੰਡੇ ਪਹਿਲੀ ਵਾਰ ਆਏ ਹਾਂ ਅਤੇ ਸਾਨੂੰ ਇੱਕ ਗਾਈਡ ਦੀ ਜ਼ਰੂਰਤ ਹੈ ਤਾਂ ਸਾਨੂੰ ਤੁਸੀਂ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਲੈ ਕੇ ਜਾਉਂਗੇ ਅਤੇ ਤੁਹਾਡੀ ਕੀ ਫੀਸ ਹੋਉਂਗੀ ਉਹ ਦੱਸ ਹਾਂਜੀ ਹਾਂਜੀ

ਹਾਂਜੀ ਠੀਕ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅਤੇ ਠੀਕ ਹੈ ਅਤੇ ਅਸੀਂ ਪਿਕ ਕਰ ਸਕਦੇ ਹਾਂ ਜੀ ਸਾਨੂੰ ਲੋਕੇਸ਼ਨ ਦੱਸ ਦਿਓ ਠੀਕ ਹੈ ਜੀ ਧੰਨ ਹਾਂਜੀ ਠੀਕ ਹੈ ਜੀ